ਸਰਕਾਰ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਬਹੁਤ ਸਾਰੀਆਂ ਮੋਬਾਇਲ ਐਪ ਹੈ ਜਿਨ੍ਹਾਂ ਵਿੱਚੋਂ ਡਿਜ਼ੀਲੌਕਰ ਵੀ ਇੱਕ ਪ੍ਰਮੁੱਖ ਐਪਲੀਕੇਸ਼ਨ ਹੈ ਇਸ ਐਪੀਕੇਸ਼ਨ ਦਾ ਮੁੱਖ ਮੰਤਵ ਇਹ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਡਾਕੂਮੈਂਟ ਨੂੰ ਇਸ ਉੱਤੇ ਸਟੋਰ ਕਰ ਸਕਦੇ ਹਾਂ ਇਸ ਦਾ ਫ਼ਾਇਦਾ ਇਹ ਹੈ ਕਿ ਸਾਨੂੰ ਕਿਤੇ ਵੀ ਕਿਸੇ ਨੂੰ ਵੀ ਆਪਣੇ ਜਿਹੜੇ ਓਰੀਜ਼ਨਲ ਫ਼ਿਜੀਕਲ ਡਾਕੂਮੈਂਟ ਨਾਲ ਲੈ ਜਾ ਕੇ ਦਿਖਾਉਣ ਦੀ ਲੋੜ ਨਹੀਂ ਜਾਂ ਉਹਨਾਂ ਦੀ ਵੈਰੀਫੀਕੇਸ਼ਨ ਜਾਂ ਉਹਨਾਂ ਨੂੰ ਉਹਨਾਂ ਨੂੰ ਪ੍ਰਤੱਖ ਤੌਰ 'ਤੇ ਦੇਖਣ ਲਈ ਕਿਸੇ ਨੂੰ ਜ਼ਰੂਰੀ ਨਹੀਂ ਕਿ ਹਰ ਡਾਕੂਮੈਂਟ ਨੂੰ ਨਾਲ ਲੈ ਕੇ ਜਾਇਆ ਜਾਵੇ ਹਰ ਤਰ੍ਹਾਂ ਦੇ ਡਾਕੂਮੈਂਟ ਦੀ ਵੇਰੀਫੀਕੇਸ਼ਨ ਡਿਜ਼ੀਲੌਕਰ ਤੋਂ ਕੀਤੀ ਜਾ ਸਕਦੀ ਹੈ ਉਦਾਹਰਨ ਦੇ ਤੌਰ 'ਤੇ ਹਰ ਸਕੂਲ ਬੋਰਡ ਜਾਂ ਯੂਨੀਵਰਸਿਟੀਆਂ ਦੇ ਸਰਟੀਫੀਕੇਟ ਹੈਗੇ ਨੇ ਜਿਹੜੇ ਉਹ ਡਿਜ਼ੀਲੌਕਰ ਦੇ ਉੱਤੇ ਸਟੋਰ ਹੁੰਦੇ ਹਨ ਜਿਵੇਂ ਹੀ ਕਿਸੇ ਕਲਾਸ ਦਾ ਇਮਤਿਹਾਨ ਆਉਂਦਾ ਹੈ ਉਸਦੇ ਸਾਰੇ ਡਾਕੂਮੈਂਟ ਡਿਟੇਲ ਮਾਰਕਸ ਕਾਰਡ ਡਿਜ਼ੀਲੌਕਰ ਦੇ ਉੱਤੇ ਪ੍ਰੋਵਾਇਡ ਕੀਤੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਉੱਥੋਂ ਯੂਜ਼ ਉੱਥੋਂ ਹੀ ਇਨ੍ਹਾਂ ਨੂੰ ਅਸੀਂ ਅਕਸੈੱਸ ਕਰ ਸਕਦੇ ਹਾਂ ਅਤੇ ਕਿਸੇ ਵੀ ਪਰਪਸ ਲਈ ਇਹਨਾਂ ਨੂੰ ਵਰਤ ਸਕਦੇ ਹਾਂ ਜਾਂ ਕਿਸੇ ਨੂੰ ਪ੍ਰੋਵਾਇਡ ਕਰਵਾਏ ਜਾ ਸਕਦੇ ਨੇ